ਕਪੂਰਥਲਾ ਸ਼ਹਿਰ ਵਿੱਚ ਕਈ ਧਾਰਮਿਕ ਅਤੇ ਭਾਈਚਾਰਕ ਸੰਸਥਾਵਾਂ ਹਨ ਜੋ ਕਿ ਸਾਰੇ ਧਰਮਾਂ ਦਾ ਆਦਰ ਕਰਦੇ ਹੋਏ ਇੱਕ ਸਮਾਨ ਸਾਰਿਆਂ ਨੂੰ ਸਮਝਦੇ ਹੋਏ ਇੱਕ ਦੂਜੇ ਦਾ ਦੇ ਦੁੱਖ ਦਰਦ ਪੀੜਾ ਨੂੰ ਸਮਝਦੇ ਹੋਏ ਉਹਨਾਂ ਦੀ ਮਦਦ ਕਰਦੇ ਹਨ ਇਹਦੇ ਵਿੱਚ ਕਈ ਹਿੰਦੂ ਕਈ ਸਿੱਖ ਕਈ ਕ੍ਰਿਸ਼ਚਨ ਸੰਸਥਾਵਾਂ ਵੀ ਅੱਜ ਕੱਲ੍ਹ ਬਹੁਤ ਅੱਗੇ ਵੱਧ ਚੜ ਕੇ ਮਦਦ ਕਰ ਰਹੀਆਂ ਹਨ ਪਰ ਜਿਹੜੇ ਮਦਦ ਕੀਤੀ ਜਾ ਰਹੀ ਹੈ ਉਹ ਕਿਸੇ ਧਰਮ ਜਾਂ ਕਿਸੇ ਜਾਤ ਨੂੰ ਵੇਖ ਕੇ ਨਹੀਂ ਸਮਾ ਕਿ ਇਸ ਤੋਂ ਉੱਪਰ ਉੱਠ ਕੇ ਕੀਤੀ ਜਾ ਰਹੀ ਹੈ ਇਹ ਸੰਸਥਾਵਾਂ ਸੜਕ ਦੇ ਕਿਨਾਰੇ ਪਏ ਅਪਾਹਜ ਬੇਘਰੇ ਬੇਲੋੜੇ ਲੋਕਾਂ ਦੀ ਮਦਦ ਕਰਦੀ ਹੈ ਜਿਨ੍ਹਾਂ ਨੂੰ ਕੋਈ ਸਾਂਭਣ ਵਾਲਾ ਨਹੀਂ ਹੈ ਕਈ ਐਸੇ ਵੀ ਲੋਕ ਹਨ ਜਿਨ੍ਹਾਂ ਨੂੰ ਉਹਨਾਂ ਦੇ ਘਰ ਵਾਲੇ ਉਹਨਾਂ ਦਾ ਪਰਿਵਾਰ ਸਾਂਭ ਨਹੀਂ ਸਕਦਾ ਉਹਨਾਂ ਦੀ ਵੀ ਮਦਦ ਕਰਦੀ ਹੈ ਕਈ ਲੋਕ ਕਈ ਲੋਕ ਐਸੇ ਵੀ ਹਨ ਜਿਨ੍ਹਾਂ ਦੇ ਕੋਈ ਸੱਟ ਪੇਟ ਜਾਂ ਕੋਈ ਬ ਬਿਮਾਰੀ ਜਾਂ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਸਰੀਰਕ ਰੋਗ ਹੈ ਪਰ ਉਹ ਆਪਣਾ ਇਲਾਜ ਕਰਵਾਉਣ ਤੋਂ ਅਸਮਰਥ ਹਨ ਇਹ ਸੰਸਥਾਵਾਂ ਉਹਨਾਂ ਦੀ ਵੀ ਮਦਦ ਕਰਦੀਆਂ ਹਨ ਇਹ ਸੰਸਥਾਵਾਂ ਹਰ ਜਿਲ੍ਹੇ ਹਰ ਸ਼ਹਿਰ ਦੇ ਅੰਦਰ ਹੋਣੀਆਂ ਜ਼ਰੂਰੀ ਹਨ ਕਿਉਂਕਿ ਇਸ ਨਾਲ ਸਮਾਜ ਵਿੱਚ ਬਹੁਤ ਫ਼ਰਕ ਵੀ ਪੈਂਦਾ ਹੈ ਅਤੇ ਇੱਕ ਭਾਈਚਾਰਕ ਸਾਂਝ ਦੀ ਸੁਨੇਹਾ ਜਾਂਦਾ ਹੈ